ਖੇਡਣ ਨਾਲ ਬਹੁਤ ਹੀ ਵਧੀਆ ਲੱਗਦਾ ਹੈ ਇਸ ਕਰਕੇ ਕਬੱਡੀ ਦਾ ਇਨਾਮ ਵੀ ਬਹੁਤ ਜ਼ਿਆਦਾ ਵੱਡਾ ਰੱਖਿਆ ਜਾਂਦਾ ਹੈ ਜੋ ਕਿ ਦੂਰ ਦੂਰ ਤੋਂ ਖਿਡਾਰੀ ਆਉਂਦੇ ਹਨ ਸਾਡੇ ਪਿੰਡ ਵਿੱਚ ਕਬੱਡੀ ਖੇਡਣ ਲਈ ਅਸੀਂ ਵੀ ਜਾ ਕੇ ਕਬੱਡੀ ਖੇਡਦੇ ਹਾਂ ਜਿਵੇਂ ਕਿ ਕਬੱਡੀ ਖੇਡਣ ਨਾਲ ਖੇਡਦੇ ਸਮੇਂ ਖਿਡਾਰੀ ਆਪਸ 'ਚ ਬਹੁਤ ਹੀ ਵਧੀਆ ਖੇਡਦੇ ਹਨ ਕਬੱਡੀ ਆਪਸ 'ਚ ਪਿਆਰ ਵੱਧਦਾ ਹੈ ਇਸ ਕਬੱਡੀ ਨੂੰ ਖੇਡਣ ਲਈ ਦੂਰ ਦੂਰ ਤੋਂ ਆਉਂਦੇ ਹਨ ਅਤੇ ਅਸੀਂ ਵੀ ਜ਼ਿਆਦਾ ਜਿੱਦਾਂ ਕਬੱਡੀ ਖੇਡਦੇ ਹਨ ਤਾਂ ਦੂਸਰਾ ਖਿਲਾੜੀ ਆਉਂਦਾ ਹੈ ਇੱਕ ਰੇਡ ਪਾਉਣ ਰੇਡ ਪਾਉਣ 'ਤੇ ਇੱਕ ਬੰ ਅਸੀਂ ਜਾ ਕੇ ਉਸ ਖਿਡਾਰੀ ਨੂੰ ਫੜਦੇ ਹਾਂ ਫੜ ਕੇ ਜਿੱਦਾਂ ਕਿ ਤੀਹ ਸੈਕਿੰਡ ਹੋ ਜਾਂਦੇ ਹਨ ਤਾਂ ਉਸ ਜੇ ਤੋਂ ਤੀਹ ਸੈਕਿੰਡਾਂ ਹੋ ਗਏ ਪੂਰੇ ਤਾਂ ਉਹ ਖਿਡਾਰੀ ਹਾਰ ਜਾਂਦਾ ਹੈ ਅਤੇ ਇੱਧਰਲਾ ਬੰਦਾ ਅਸੀਂ ਜਿੱਤ ਜਾਂਦੇ ਹਾਂ ਕਬੱਡੀ ਬਹੁਤ ਹੀ ਵਧੀਆ ਖੇਡ ਹੈ